ਮੇਰਾ ਮਨਪਸੰਦ ਭੋਜਨ ਜੋ ਹੈ ਅੱਜ ਦੇ ਸਮੇਂ ਦੇ ਅਨੁਸਾਰ ਪੀਜ਼ਾ ਪਾਸਤਾ ਕੋਲਡ ਡਰਿੰਕ ਹੋ ਗਈ ਇਹ ਚੀਜ਼ਾਂ ਬਹੁਤ ਪਸੰਦ ਕਰਦੇ ਹਾਂ ਜਿਵੇਂ ਕਿ ਅਸੀਂ ਬਾਹਰ ਕਤੀਕ ਘੁੰਮਣ ਜਾਈਏ ਤਾਂ ਇਹ ਚੀਜ਼ਾਂ ਸਾਡੇ ਲਾਗੇ ਇੱਕ ਪਜ਼ੇਰੀਆ ਰੈਸਟੋਰੈਂਟ ਹੈ ਉੱਥੋਂ ਦਾ ਪਾਸਤਾ ਪੀਜ਼ਾ ਬਹੁਤ ਲਾਇਕ ਕਰਦੇ ਨੇ ਲੋਕ ਮੈਨੂੰ ਖੁਦ ਨੂੰ ਬਹੁਤ ਪਸੰਦ ਹੈ ਖਾਣਾ ਪਸੰਦ ਕਰਦੇ ਹਾਂ ਨਿਊਡਲ ਹੋਏ ਟਿੱਕੀਆਂ ਹੋਈਆਂ ਬਰਗਰ ਹੋਏ ਇਹ ਸਭ ਚੀਜ਼ਾਂ ਉੱਥੇ ਬਹੁਤ ਵਧੀਆ ਕੁਆਲਿਟੀ ਦੀਆਂ ਮਿਲਦੀਆਂ ਨੇ ਡੋਸਾ ਮੇਰਾ ਫੇਵਰੇਟ ਹੈ ਹੋਰ ਇਡਲੀ ਸਾਂਬਰ ਹਰ ਚੀਜ਼ ਉੱਥੇ ਮਿਲਦੀ ਹੈ ਜੋ ਕਿ ਅਸੀਂ ਆਪਣੀ ਇੱਛਾ ਅਨੁਸਾਰ ਖਾ ਸਕਦੇ ਹਾਂ ਢੋਕਲਾ ਵੀ ਇਹ ਹੀ ਮਨਪਸੰਦ ਚੀਜ਼ਾ ਨੇ